ਮੈਂ ਆਪਣੇ ਕੋਲਜ ਦੀ ਪੜ੍ਹਾਈ ਦੇ ਨਾਲ ਨਾਲ ਅ ਸਰਕਾਰੀ ਪੇਪਰਾਂ ਦੀ ਤਿਆਰੀ ਸ਼ੁਰੂ ਕੀਤੀ ਹੈ ਸਰਕਾਰੀ ਪੇਪਰਾਂ ਦੀ ਤਿਆਰੀ ਕਰਨ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਉਹਨਾਂ ਦੇ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ ਹੈ ਜਿਸ ਵਿੱਚ ਮੈਨੂੰ ਇਹ ਪਤਾ ਚੱਲਿਆ ਹੈ ਕਿ ਹਰੇਕ ਪੇਪਰ ਦੇ ਸਾਰੇ ਹਰੇਕ ਪੇਪਰ ਦੇ ਸਬਜੈਕਟ ਜਿਹੜੇ ਹਨ ਸਾਰੇ ਸੇਮ ਹੀ ਹਨ ਸਾਰਿਆਂ ਦਾ ਸਿਲੇਬਸ ਹ ਹ ਕਿਸੇ ਹੱਦ ਤੱਕ ਸੇਮ ਹੀ ਹੈ ਜਿਸ ਦਾ ਮੈਂ ਇੱਕ ਵੇਰਵਾ ਬਣਾ ਕੇ ਉਸਦੀ ਤਿਆਰੀ ਸ਼ੁਰੂ ਕੀਤੀ ਹੈ ਕੁਛ ਸਬਜੈਕਟ ਮੈਂ ਸਵੇਰੇ ਪੜ੍ਹਦੀ ਹਾਂ ਜਿਵੇਂ ਜੀ ਕੇ ਜਿਸ ਦੀ ਸਰਕਾਰੀ ਪੇਪਰਾਂ ਵਿੱਚ ਬਹੁ ਕਾਫੀ ਜ਼ਿਆਦਾ ਮਹੱਤਤਾ ਹੈ ਅਤੇ ਇਸ ਨੂੰ ਸਕੋਰ ਇਸ ਵਿੱਚ ਸਕੋਰ ਕੱਢਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਅਤੇ ਇਸ ਲਈ ਮੈਂ ਇਸ ਨੂੰ ਸਵੇਰੇ ਉੱਠ ਕੇ ਪੜ੍ਹਦੀ ਹਾਂ ਅਤੇ ਬਾਕੀ ਸਬਜੈਕਟ ਮੈਂ ਥੋੜ੍ਹੇ ਸ਼ਾਮ ਨੂੰ ਪੜ੍ਹਦੀ ਹਾਂ ਅਇਸ ਦੇ ਨਾਲ ਨਾਲ ਮੈਂ ਆਪਣੀ ਕੋਲਜ ਦਾ ਜਿਹੜਾ ਕੋਰਸ ਮੈਂ ਚਲਾ ਰਹੀ ਹਾਂ ਤਾਂ ਉਸ ਦੀ ਵੀ ਪੜ੍ਹਾਈ ਵੀ ਕਾਫੀ ਵਧੀਆ ਤਰੀਕੇ ਨਾਲ ਕਰ ਰਹੀ ਹਾਂ ਤਾਂ ਕਿ ਮੇਰੇ ਉਸ ਵਿੱਚ ਵੀ ਕਿਤੇ ਮਾਕਸ ਨਾ ਘੱਟ ਹੋਣ ਉਸਨੂੰ ਵੀ ਮੈਂ ਬਹੁਤ ਵਧੀਆ ਤਰੀਕੇ ਨਾਲ ਆਪਣੇ ਸਰਕਾਰੀ ਪੇਪਰ ਦੀ ਤਿਆਰੀ ਦੇ ਨਾਲ ਚਲਾ ਰਹੀ ਹਾਂ